ਸਾਡੀ ਪੰਜਾਬੀ ਭਾਸ਼ਾ ਨੂੰ ਲੈ ਕੇ ਕੁਝ ਗਲਤ ਧਾਰਨਾਵਾਂ ਇਸ ਤਰ੍ਹਾਂ ਹਨ ਜਿੱਦਾਂ ਕਿ ਅਸੀਂ ਆਹ ਦੇਖ ਹੀ ਰਹੇ ਹਾਂ ਕਿ ਬ ਅੱਜ ਕੱਲ੍ਹ ਦੇ ਬੱਚਿਆਂ ਦੇ ਵਿੱਚ ਬਾਹਰ ਜਾਣ ਦਾ ਰੁਝਾਨ ਬਹੁਤ ਹੀ ਵੱਧ ਗਿਆ ਹੈ ਅਤੇ ਜਦੋਂ ਬੱਚੇ ਬਾਹਰੋਂ ਵਾਪਸ ਆਉਂਦੇ ਹਨ ਪੰਜਾਬ ਦੇ ਵਿੱਚ ਤਾਂ ਉਹ ਆਪਣੇ ਪੰਜਾਬੀ ਭਾਸ਼ਾ ਬੋਲਦੇ ਹੋਏ ਸ਼ਰਮ ਮਹਿਸੂਸ ਕਰਦੇ ਹਨ ਜਦ ਕਿ ਸਾਡੇ ਪੰਜਾਬੀਆਂ ਦੀ ਮਾਂ ਬੋਲੀ ਪੰਜਾਬੀ ਹੈ ਸਰਹੱਦ ਅਤੇ ਸੱਚ ਅਚਾਰ ਵਾਲੇ ਮਨੁੱਖ ਆਪਣੀ ਮਾਂ ਬੋਲੀ ਦਾ ਪਿਆਰ ਅਤੇ ਸਤਿਕਾਰ ਆਪਣੀ ਮਾਂ ਜਿੰਨਾਂ ਹੀ ਕਰਦੇ ਹਨ ਅਤੇ ਇਸ ਦੀ ਚੜ੍ਹਦੀ ਕਲਾ ਵਿੱਚ ਨਿਰੀ ਅਰਦਾਸ ਹੀ ਨਹੀਂ ਕਰਦੇ ਬਲਕਿ ਹਰ ਦਮ ਯਤਨਸ਼ੀਲ ਵੀ ਰਹਿੰਦੇ ਹਨ ਜਦੋਂ ਵੀ ਉਹ ਮਹਿਸੂਸ ਕਰਦੇ ਹਨ ਕਿ ਪੰਜਾਬੀ ਹੀ ਆਪਣੀ ਮਾਂ ਬੋਲੀ ਦੀ ਯੋਗ ਵਰਤੋਂ ਨਹੀਂ ਕਰਦੇ ਤਾਂ ਉਹ ਇਸ ਦੇ ਵਿਰੁੱਧ ਆਪਣੀ ਆਵਾਜ਼ ਵੀ ਬੁਲੰਦ ਕਰਦੇ ਹਨ ਕੁਝ ਰਾਜਨੀਤਿਕ ਲੋਕਾਂ ਨੇ ਆਪਣੇ ਸਵਾਰਥ ਲਈ ਭਾਸ਼ਾ ਮਜ਼ਹਬ ਦਾ ਗਠਜੋੜ ਕਰ ਦਿੱਤਾ ਹੈ ਜਿਵੇਂ ਹਿੰਦੂ ਹਿੰਦੀ ਮੁਸਲਮਾਨ ਉਰਦੂ ਅਤੇ ਸਿੱਖ ਪੰਜਾਬੀ ਇਸ ਕਰਕੇ ਸਾਡੀ ਮਾਂ ਬੋਲੀ ਪੰਜਾਬੀ ਦਾ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿੱਚ ਬਹੁਤ ਨੁਕਸਾਨ ਹੋਇਆ ਹੈ ਦੂਜਾ ਨੁਕਸਾਨ ਵਿਸ਼ਵੀਕਰਨ ਕਾਰਨ ਹੋਇਆ ਹੈ ਵਿਸ਼ਵੀਕਰਨ ਦਾ ਨਵਾਂ ਦੈਤ ਹਰ ਮਹੀਨੇ ਦੋ ਬੋਲੀਆਂ ਚਟਮ ਕਰ ਦਿੰਦਾ ਹੈ ਪਿਛਲੇ ਯੁੱਗਾਂ ਵਿੱਚ ਜਰਵਾਣੇ ਆਪਣੀ ਰਿਆਇਆ ਉੱਤੇ ਆਪਣੀ ਭਾਸ਼ਾ ਬਦੋ ਬਧੀ ਠੋਸਦੇ ਸਨ ਪਰ ਵਿਸ਼ਵੀਕਰਨ ਦੇ ਯੁੱਗ ਵਿੱਚ ਬੁਲਾਰੇ ਆਪਣੀ ਮਰਜ਼ੀ ਨਾਲ ਬਲਕਿ ਖੁਸ਼ੀ ਨਾਲ ਆਪਣੀ ਮਾਂ ਬੋਲੀ ਦੀ ਕੁਰਬਾਨੀ ਦੇ ਕੇ ਵਿਦੇਸ਼ੀ ਭਾਸ਼ਾ ਅੰਗਰੇਜ਼ੀ ਨੂੰ ਆਪਣੇ ਬੱਚਿਆਂ ਦੀ ਮਾਂ ਬੋਲੀ ਬਣਾਉਣ ਵਿੱਚ ਫਖਰ ਮਹਿਸੂਸ ਕਰਨ ਲੱਗ ਪਏ ਹਨ ਪੰਜਾਬ ਦੇ ਪਬਲਿਕ ਸਕੂਲਾਂ ਵਿੱਚ ਜਿੱਥੇ ਮੈਂ ਇੱਕ ਹੋਰ ਗੱਲ ਵਿਲੱਖਣ ਵੇਖੀ ਹੈ ਉੱਥੇ ਪੰਜਾਬੀ ਬੋਲਣ ਵਾਲੇ ਬੱਚਿਆਂ ਨੂੰ ਜੁਰਮਾਨਾ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਅੰਗਰੇਜ਼ੀ ਜਾਂ ਹਿੰਦੀ ਬੋਲਣ ਲਈ ਮਜ਼ਬੂਰ ਕੀਤਾ ਜਾਂਦਾ ਹੈ ਜਦੋਂ ਮੈਂ ਅੰਮ੍ਰਿਤਸਰ ਦੇ ਸਿਰ ਕੱਢ ਪਬਲਿਕ ਸਕੂਲ ਦੇ ਪ੍ਰਧਾਨ ਨੂੰ ਪੁੱਛਿਆ ਕਿ ਤੁਸੀਂ ਪੰਜਾਬੀ ਦੀ ਥਾਂ ਹਿੰਦੀ ਨੂੰ ਕਿਉਂ ਪਹਿਲ ਦਿੰਦੇ ਹੋ ਜਦ ਉਹਨੇ ਬੱਚੇ ਦਾ ਪੰਜਾਬ ਵਿੱਚ ਰਹਿਣ ਵਾਲੇ ਹਨ ਇਹ ਸੁਣ ਕੇ ਉਹਨਾਂ ਨੇ ਜਵਾਬ ਦਿੱਤਾ ਸਾਨੂੰ ਬੱਚਿਆਂ ਦੇ ਮਾਂ ਬਾਪ ਆਪ ਕਹਿੰਦੇ ਹਨ ਕਿ ਇਹਨਾਂ ਨੂੰ ਅੰਗਰੇਜ਼ੀ ਸਿਖਾਓ ਅਤੇ ਸਾਨੂੰ ਇਹਨਾਂ ਦੇ ਵੱਧ ਪੈਸੇ ਦਿੱਤੇ ਜਾਂਦੇ ਹਨ ਪੰਜਾਬੀ ਭਾਸ਼ਾਵਾਂ ਦੇ ਮਾਹਿਰਾਂ ਨੂੰ ਵਿਗਿਆਨ 'ਤੇ ਮਜ਼ਮੂਨਾਂ ਲਈ ਸ਼ਬਦਾਵਲੀ ਤਿਆਰ ਕਰਨੀ ਚਾਹੀਦੀ ਹੈ ਤਾਂ ਕਿ ਉਚੇਰੀ ਪੜ੍ਹਾਈ ਵੀ ਇਸ ਭਾਸ਼ਾ ਵਿੱਚ ਹੋ ਸਕੇ ਕਿਉਂਕਿ ਵਿਗਿਆਨ ਦੀ ਉਚੇਰੀ ਵਿੱਦਿਆ ਲਈ ਸਾਨੂੰ ਅੰਗਰੇਜ਼ੀ 'ਤੇ ਨਿਰਭਰ ਹੋਣਾ ਪੈਂਦਾ ਹੈ ਸਾਨੂੰ ਮਾਣ ਹੈ ਕਿ ਦੁਨੀਆਂ ਦਾ ਸਰਬ ਸਾਂਝਾ ਅਧਿਆਤਮਿਕ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਪੰਜਾਬੀ ਭਾਸ਼ਾ ਵਿੱਚ ਹੈ ਅਤੇ ਸਾਨੂੰ ਸਭ ਨੂੰ ਆਪਣੀ ਮਾਤ ਭਾਸ਼ਾ ਪੰਜਾਬੀ ਨਾਲ ਪਿਆਰ ਕਰਨਾ ਚਾਹੀਦਾ ਹੈ